ਪੰਜਾਬ ਦੇ ਵਿੱਚ ਜ਼ਿਆਦਾ ਨਾਈਟ ਲਾਈਫ ਦਾ ਕਲਚਰ ਨਹੀਂ ਹੈ ਫਿਰ ਵੀ ਜੇ ਨਾਈਟ ਲਾਈਫ ਦੀ ਗੱਲ ਕੀਤੀ ਜਾਵੇ ਤਾਂ ਰਾਤ ਦੇ ਸਮੇਂ ਜੋ ਸਟਰੀਟ ਫੂਡ ਹੁੰਦਾ ਹੈ ਉਹ ਇੱਕ ਮਨੋਰੰਜਨ ਦਾ ਹਰਮਨ ਪਿਆਰਾ ਸਾਧਨ ਹੈ ਉਸ ਤੋਂ ਇਲਾਵਾ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਕੈਫੇ ਰੈਸਟੋਰੈਂਟ ਆਦਿ ਖੁੱਲ ਗਏ ਹਨ ਜਾਂ ਪੀ ਵੀ ਆਰ ਸਿਨੇਮਾ ਜਾਂ ਬਹੁਤ ਵੱਡੇ ਵੱਡੇ ਮੌਲ ਕਈ ਜ਼ਿਲ੍ਹਿਆਂ ਦੇ ਵਿੱਚ ਖੁੱਲ ਗਏ ਹਨ ਤਾਂ ਉਹ ਇੱਕ ਨਾਈਟ ਲਾਈਫ ਅਤੇ ਮਨੋਰੰਜਨ ਦਾ ਚੰਗਾ ਸਾਧਨ ਹੈ